ਖਾਣ ਵਿੱਚ ਮੇਰੀ ਮਨਪਸੰਦ ਕਿਸਮ ਦਾ ਭੋਜਨ ਹੈ ਸਾਗ ਸਾਗ ਆਪਾਂ ਸਰ੍ਹੋਂ ਦੇ ਖੇਤਾਂ ਵਿੱਚੋਂ ਤੋੜ ਕੇ ਲਿਆਉਂਦੇ ਹਾਂ ਗੰਦਲਾਂ ਦਾ ਸਾਗ ਬਹੁਤ ਪਸੰਦ ਹੈ ਗੰਦਲਾਂ ਦਾ ਸਾਗ ਤੋੜ ਕੇ ਵਿੱਚ ਮੇਥੇ ਪਾ ਕੇ ਪਾਲਕ ਪਾ ਕੇ ਬਹੁਤ ਸਵਾਦਿਸ਼ਟ ਬਣਦਾ ਹੈ ਅਤੇ ਆਪਾਂ ਇਹਨੂੰ ਜਦੋਂ ਚੁੱਲ੍ਹੇ 'ਤੇ ਬਣਾਈਏ ਤਾਂ ਇਹਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਅਤੇ ਅਖੀਰ ਵਿੱਚ ਅੱਲ੍ਹਣ ਪਾ ਕੇ ਤੜਕਾ ਲਗਾ ਕੇ ਇਹਨੂੰ ਫਾਈਨਲ ਖਾਣ ਲਈ ਤਿਆਰ ਕੀਤਾ ਜਾਂਦਾ ਹੈ ਸਾਗ ਚੁੱਲ੍ਹੇ 'ਤੇ ਬਹੁਤ ਸਵਾਦ ਬਣਦਾ ਹੈ ਅਤੇ ਨਾਲ ਮੱਕੀ ਦੀ ਰੋਟੀ ਅਤੇ ਉੱਤੇ ਮੱਖਣ ਪਾ ਕੇ ਇਹਦਾ ਸਵਾਦ ਦੁੱਗਣਾ ਹੋਰ ਹੋ ਜਾਂਦਾ ਹੈ ਅਤੇ ਘਰ ਦਾ ਬਣਿਆ ਸਾਗ ਤਾਂ ਬਹੁਤ ਬੱਚਿਆਂ ਅਤੇ ਸਿਆਣਿਆਂ ਨੂੰ ਸਭ ਨੂੰ ਬਹੁਤ ਪਸੰਦ ਆਉਂਦਾ ਹੈ